ਵਹਿਮ ਭਰਮ ਦੀ ਅਧਾਰਸ਼ਿਲਾ ਡਰ ਹੈ ਜਦੋਂ ਵਿਅਕਤੀ ਵੱਖ ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿੱਦਿਆ ਨੂੰ ਅਪਣਾਉਣਾ ਸ਼ੁਰੂ ਕੀਤਾ ਮਨੁੱਖ ਇੱਕ ਸਮਾਜਿਕ ਵਾਤਾਵਰਨ ਵਿੱਚ ਰਹਿੰਦਾ ਹੈ ਵਿਸ਼ਵਾਸ ਇਸ ਵਾਤਾਵਰਨ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ ਪਰੰਪਰਾ ਕਹਿੰਦੇ ਹਾਂ ਵਿਸ਼ਵਾਸ ਅਤੇ ਵਹਿਮ ਇੱਕੋ ਸਿੱਕੇ ਦੇ ਦੋ ਪਾਸੇ ਹਨ ਜਿਹੜਾ ਸਿੱਕਾ ਸਾਨੂੰ ਪਰੰਪਰਾ ਤੋਂ ਪ੍ਰਾਪਤ ਹੋਇਆ ਹੈ ਵਹਿਮ ਭਰਮ ਦੀਆਂ ਵੱਖੋ ਵੱਖ ਵੰਨਗੀਆਂ ਹਨ ਅਪਸ਼ਗਨ ਅਤੇ ਸ਼ੁਭ ਸ਼ਗਨ ਵੀ ਵਹਿਮ ਭਰਮ ਦੇ ਹੀ ਦੋ ਸਿੱਕੇ ਹਨ ਅਪਸ਼ਗਨਾਂ ਵਿੱਚ ਸਾਡੇ ਇਲਾਕੇ ਵਿੱਚ ਕੁਝ ਕੁ ਵਹਿਮ ਇਹ ਹਨ ਜਿਵੇਂ ਕਿਸੇ ਕੰਮ ਨੂੰ ਜਾਣ ਲੱਗੇ ਜੇ ਕੋਈ ਪਿੱਛੋਂ ਆਵਾਜ਼ ਮਾਰਦੇ ਇਸਨੂੰ ਅਪਸ਼ਗਨ ਮੰਨਿਆ ਜਾਂਦਾ ਹੈ ਕਿਸੇ ਕੰਮ ਨੂੰ ਜਾਣ ਲੱਗੇ ਜੇ ਕੋਈ ਕਾਲੀ ਬਿੱਲੀ ਰਸਤਾ ਕੱਟ ਦੇਵੇ ਤਾਂ ਇਸਨੂੰ ਵੀ ਅਪਸ਼ਗਨ ਮੰਨਿਆ ਜਾਂਦਾ ਹੈ ਜੇ ਪਿੱਛੋਂ ਕੋਈ ਛਿੱਕ ਮਾਰ ਦੇਵੇ ਤਾਂ ਇਸਨੂੰ ਵੀ ਅਪਸ਼ਗਨ ਮੰਨਿਆ ਜਾਂਦਾ ਹੈ ਇਹਨਾਂ ਅਪਸ਼ਗਨਾਂ ਦੇ ਹੋਣ 'ਤੇ ਇਹ ਸੋਚ ਰੱਖੀ ਜਾਂਦੀ ਹੈ ਕਿ ਹੋਣ ਵਾਲਾ ਕੰਮ ਨਹੀਂ ਹੋਏਗਾ ਉਹਦੇ ਵਿੱਚ ਕੁਝ ਨਾ ਕੁਝ ਵਿਘਨ ਆ ਪਵੇਗਾ ਇਸ ਤਰ੍ਹਾਂ ਕੁਝ ਸ਼ੁਭ ਸ਼ਗਨ ਵੀ ਹੁੰਦੇ ਹਨ ਜਿਵੇਂ ਕਿ ਕਿਸੇ ਕੰਮ ਨੂੰ ਜਾਂਦੇ ਜੇ ਤਿੱਤਰ ਦਿੱਖ ਪੈਣ ਤਾਂ ਇਸ ਨੂੰ ਚੰਗਾ ਸ਼ਗਨ ਮੰਨਿਆ ਜਾਂਦਾ ਹੈ